ਹਾਂਜੀ ਸਰ ਸਰ ਮੇਰਾ ਬੀਮਾ ਤੁਹਾਡੇ ਜਿਹੜੀ ਕੰਪਨੀ ਹੈਗੀ ਹੈ ਐਲ ਆਈ ਸੀ ਉਹਦੇ ਵਿੱਚ ਚੱਲ ਰਿਹਾ ਤਾਂ ਸਰ ਮੈਂ ਇੱਕ ਸਰਜਰੀ ਆਪਦੇ ਮੋਢੇ ਦੀ ਕਰਾਉਣ ਬਾਰੇ ਸੋਚ ਰਹੀ ਹਾਂ ਤਾਂ ਸਰ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਮੇਰਾ ਜਿਹੜਾ ਸਿਹਤ ਬੀਮਾ ਮੈਂ ਕਰਵਾਇਆ ਉਹਦੇ ਵਿੱਚ ਕੀ ਆਉਂਦਾ ਵਾ ਮੈਂ ਕਰਵਾ ਸਕਦੀ ਹਾਂ ਅਤੇ ਇਹਦੇ ਵਿੱਚ ਮੈਨੂੰ ਕੀ ਹੈਲਪ ਮਿਲੇਗੀ ਤੁਸੀਂ ਮੈਨੂੰ ਕਿੰਨੇ ਕੁ ਪੈਸੇ ਦਉਗੇ ਇਸ ਚੀਜ਼ ਸੰਬੰਧੀ ਜੇਕਰ ਮੈਂ ਸਰਜਰੀ ਕਰਵਾਉਂਦੀ ਹਾਂ ਤਾਂ ਪਲੀਜ਼ ਤੁਸੀਂ ਮੈਨੂੰ ਥੋੜ੍ਹਾ ਜਿਹਾ ਮੇਰੀ ਹੈਲਪ ਕਰੋ ਕਿ ਮੈਂ ਕਿਸ ਤਰੀਕੇ ਨਾਲ ਆਪਦੀ ਸਰਜਰੀ ਦੇ ਵਿੱਚ ਤੁਹਾਡੀ ਹੈਲਪ ਲੈ ਸਕਦੀ ਹਾਂ ਪਲੀਸ ਮੈਨੂੰ ਥੋੜ੍ਹਾ ਜਿਹਾ ਦੱਸੋ ਇਸ ਚੀਜ਼